ਹਾਂਜੀ ਏਸ਼ੀਆ ਟਰੈਵਲਿੰਗ ਏਜੰਸੀ ਤੋਂ ਬੋਲ ਰਹੇ ਹੋ ਜੀ ਹਾਂਜੀ ਹਾਂਜੀ ਹਾਂਜੀ ਮੈਨੂੰ ਜੀ ਮੈਂ ਲਖਵੀਰ ਕੌਰ ਬੋਲ ਰਹੀ ਹਾਂ ਯੂਨੀਵਰਸਿਟੀ ਤੋਂ ਬੋਲ ਰਹੀ ਹਾਂ ਜੀ ਹਾਂਜੀ ਮੈਂ ਇੱਥੇ ਮੈਂ ਕੱਲ੍ਹ ਏਰਪੋਰਟ 'ਤੇ ਜਾਣਾ ਸੀ ਅਤੇ ਮੈਨੂੰ ਮੇਰੇ ਫਰੈਂਡ ਨੇ ਤੁਹਾਡੇ ਮਤਲਬ ਏਜੰਸੀ ਦਾ ਮੈਨੂੰ ਰੈਫਰੈਂਸ ਦਿੱਤਾ ਸੀ ਹਾਂਜੀ ਹਾਂਜੀ ਅਤੇ ਉਹਨਾਂ ਨੇ ਦੱਸਿਆ ਸੀ ਵੀ ਮਤਲਬ ਬਹੁਤ ਵਧੀਆ ਉਹਨਾਂ ਦੀ ਸਰਵਿਸ ਹੈਗੀ ਆ ਸੋ ਇਸ ਲਈ ਮੈਂ ਤੁਹਾਨੂੰ ਮਤਲਬ ਕੋਲ ਕਰ ਰਹੀ ਹਾਂ ਹਾਂਜੀ ਹਾਂਜੀ ਸਰ ਮੈਂ ਮੈਂ ਕੱਲ੍ਹ ਜਾ ਰਹੀ ਹਾਂ ਤਿੰਨ ਵਜੇ ਜਾਣਾ ਹਾਂਜੀ ਅਤੇ ਤੁਸੀਂ ਆਪਣੀ ਕੈਬ ਪਲੀਜ਼ ਭੇਜ ਦਿਉ ਹਾਂਜੀ ਅਤੇ ਕਿੰਨੇ ਚਾਰਜਿਸ ਹੋਣਗੇ ਜੀ ਅੱਛਾ ਡੇਢ ਸੌ ਰੁਪਇਆ ਠੀਕ ਆ ਜੀ ਅਤੇ ਪਲੀ ਹਾਂਜੀ ਨਹੀਂ ਨਹੀਂ ਮੈਂ ਕੱਲ੍ਹ ਦੁਪਹਿਰ ਵੇਲੇ ਜਾਣਾ ਅਰਲੀ ਮੋਰਨਿੰਗ ਮਤਲਬ ਰਾਤ ਨੂੰ ਨਹੀਂ ਮੈਂ ਜਾਣਾ ਹਾਂਜੀ ਕਿਉਂ ਨਹੀਂ ਵੈਸੇ ਵੀ ਥੋੜ੍ਹਾ ਜਿਹਾ ਸਿਕਿਉਰਟੀ ਟਾਈਟ ਹੁੰਦੀ ਹੈ ਅਤੇ ਦਿਨ ਵੇਲੇ ਹੀ ਤੁਸੀਂ ਮੈਨੂੰ ਪਲੀਜ਼ ਇੱਥੋਂ ਡਿਪਾਰਟਮੈਂਟ ਤੋਂ ਹੀ ਪਿਕ ਕਰ ਲਿਓ ਹਾਂਜੀ ਹਾਂਜੀ ਮੇਰਾ ਡਿਪਾਰਟਮੈਂਟ ਹੈ ਗੁਰੂ ਗ੍ਰੰਥ ਸਾਹਿਬ ਭਵਨ ਜੀ ਹਾਂਜੀ ਹਾਂਜੀ ਅਤੇ ਹਾਂਜੀ ਤੁਹਾਡੇ ਜਿਹੜੇ ਹਾਂਜੀ ਜਿਹੜਾ ਡਰਾਈਵਰ ਭੇਜਣਾ ਪਲੀਜ਼ ਉਹ ਕੋਈ ਨਸ਼ਾ ਵਗੈਰਾ ਨਾ ਕਰਦਾ ਹੋਏ ਅੱਛਾ ਜੀ ਠੀਕ ਆ ਜੀ ਤੁਹਾਡਾ ਡਰਾਈਵਰ ਠੀਕ ਹੈ ਜੀ ਠੀਕ ਹੈ ਠੀਕ ਹੈ ਡਰਾਈਵਰ ਤੁਹਾਡੀ ਬਹੁਤ ਵਧੀਆ ਚਲੋ ਠੀਕ ਆ ਜੀ ਹਾਂਜੀ ਅਤੇ ਪਲੀਜ਼ ਹਾਂਜੀ ਫਿਰ ਤੁਸੀਂ ਜੀ ਕੱਲ੍ਹ ਬਿਲਕੁਲ ਹਾਂਜੀ ਮੈਂ ਤਿਆਰ ਰਹਾਂਗੀ ਤੁਸੀਂ ਤਿੰਨ ਵਜੇ ਪਲੀਜ਼ ਉਹਨਾਂ ਨੂੰ ਸ਼ਾਰਪ ਤਿੰਨ ਵਜੇ ਭੇਜ ਦਿਉ ਤਾਂ ਕਿ ਮੈਂ ਲੇਟ ਨਾ ਹੋਵਾਂ ਹਾਂਜੀ ਮੈਨੂੰ ਪਲੀਜ਼ ਹਾਂਜੀ ਹਾਂਜੀ ਕਿਉਂਕਿ ਮੇਰੀ ਫਲਾਈਟ ਮਿਸ ਨਾ ਹੋ ਜਾਵੇ ਹਾਂਜੀ ਮੈਂ ਟਾਈਮਲੀ ਹੀ ਪਹੁੰਚਣਾ ਚਾਹੁੰਦੀ ਹਾਂ ਉਹ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ